ਹੈਲੋ ਹਾਂਜੀ ਹਾਂਜੀ ਸਰ ਸਤਿ ਸ਼੍ਰੀ ਅਕਾਲ ਸਰ ਹਾਂਜੀ ਹਾਂਜੀ ਕੀ ਨਾਂ ਤੁਸੀਂ ਠੀਕ ਹੈ ਜੀ ਅਤੇ ਕਿੰਨੇ ਦਿਨ ਹੋਗੇ ਜੀ ਅੱਛਾ ਪਿਛਲੇ ਹਫਤੇ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਏਹੀ ਰੇਟ ਹੈ ਸਾਡਾ

ਕਿਓਂ ਇਹ ਕੀ ਹੋ ਗਿਆ ਤੁਸੀਂ ਜਿਹੜਾ ਤੁਹਾਡਾ ਅਸੀਂ ਸਾਈਜ ਜਿਹੜਾ ਇੱਥੇ ਲਿਖਿਆ ਸੀ ਜੀ ਜਿਹੜਾ ਮੇਜ਼ਰ ਕੀਤਾ ਸੀ ਓਹੀ ਓਸ ਸਾਬ ਨਾਲ ਹੀ ਸ਼ਰਟ ਤਿਆਰ ਕੀਤੀ ਹੈ ਨਾ ਨਹੀਂ ਤੁਸੀਂ ਤੁਸੀਂ ਜਦੋਂ ਇੱਥੇ ਆਏ ਸੀ ਟਰਾਈ ਵੀ ਕੀਤਾ ਸੀ ਨਾ ਨਹੀਂ ਵੈਸੇ ਤਾਂ ਮੈਂ ਆਪ ਹੀ ਕਰਦਾ ਵਾਈ ਚਾਂਸ ਜਿਵੇਂ ਦੋ ਤਿੰਨ ਦਿਨ ਲਈ ਮੈਂ ਬਾਹਰ ਕਿੱਥੇ ਗਿਆ ਸੀ ਕਾਰੀਗਰ ਸੀਗੇ ਇੱਥੇ

ਤੁਸੀਂ ਟਰਾਈ ਨਹੀਂ ਕੀਤਾ ਜੀ ਨਹੀਂ ਨਹੀਂ ਅੱਪ ਨਹੀਂ ਵੈਸੇ ਤਾਂ ਵਧੀਆ ਕੀਤਾ ਸੀ ਜੀ ਅਸੀਂ ਤਾਂ ਬਾਕੀ ਫੇਰ ਵੀ ਜੇ ਕੋਈ ਹੈ ਹੈਗੀ ਦਿੱਕਤ ਕੋਈ ਨਹੀਂ ਅੱਛਾ ਨਹੀਂ ਨਹੀਂ ਉਹ ਨਹੀਂ ਨਹੀਂ ਨਹੀਂ ਉਹ ਤਾਂ ਚਲੋ ਕੋਈ ਗੱਲ ਨਹੀਂ ਅਸੀਂ ਸਹੀ ਕਰ ਦਿਆਂਗੇ ਜਿਵੇਂ ਵੀ ਹੋਈ ਸ਼ਰਟ ਦੇ ਐਕਸਟਰਾ ਕੱਪੜਾ ਵਿੱਚ ਕੀਤਾ ਹੀ ਹੁੰਦਾ ਸਟੀਚਿੰਗ ਜਦੋਂ ਕਰਦੇ ਹਾਂ ਨਹੀਂ ਉਹ ਤਾਂ ਫੇਰ ਓਸ ਹਿਸਾਬ 'ਤੇ ਜਾਂ ਤਾਂ ਫੇਰ ਜਾਂ ਫੇਰ ਜੇ ਤੁਸੀਂ ਚਾਹੁੰਦੇ ਹੋ ਜਿਵੇਂ ਤਾਂ ਫੇਰ ਅਸੀਂ ਹਾਫ ਕਰ ਦਿੰਦੇ ਹਾਂ ਉਹ ਇਲਾਜ ਹੋ ਸਕਦਾ ਨਹੀਂ ਨਹੀਂ ਤੁਸੀਂ ਜੋ ਸਾਈਜ ਇੱਥੇ ਲਿਖਾ ਕੇ ਗਏ ਤੁਸੀਂ ਨੋਟ ਕਰਾਇਆ ਸੀ ਓਹੀ ਸੀਗਾ ਹੋਰ ਤਾਂ ਕੋਈ ਨਹੀਂ ਓਸ ਸਮੇਂ ਤਿਆਰ ਕਰਦੇ ਨਾ ਜੀ ਆਪਾਂ

ਨਹੀਂ ਨਹੀਂ ਕੋਈ ਨਹੀਂ ਜਦ ਤੁਹਾਡਾ ਸੋਲਵ ਕਰ ਦਿਆਂਗੇ ਜੋ ਵੀ ਹੈ ਨਹੀਂ ਤਾਂ ਫੇਰ ਤੁਹਾਨੂੰ ਜੋ ਵੀ ਹੋਵੇਗਾ ਅਸੀਂ ਕੱਪੜਾ ਫੇਰ ਆਪ ਜੋ ਵੀ ਤੁਹਾਨੂੰ ਪਸੰਦ ਹੈ ਉਹ ਦੁਆ ਕੇ ਅਸੀਂ ਸਿਲਾਈ ਕਰਕੇ ਦੇ ਦਾਂਗੇ ਨਹੀਂ ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਹੈ ਆਪਾਂ ਦੁਬਾਰਾ ਸਟਿਚਿੰਗ ਜੇ ਹੋਣੀ ਉਹ ਤਾਂ ਦੁਬਾਰਾ ਤਾਂ ਚਲੋ ਨਹੀਂ ਸਹੀ ਹੋਣੀ ਜੇ ਫੇਰ ਵੀ ਹੈ ਕੋਈ ਤਾਂ ਆਪਾਂ ਦੁਬਾਰਾ ਕਰਵਾ ਦੇਂਗੇ ਹੋਰ ਕੱਪੜਾ ਲੈ ਕੇ ਨਾ ਉਹੋ ਜਿਹਾ ਅਸੀਂ ਹਾਂਜੀ ਹਾਂਜੀ ਜ਼ਰੂਰ ਨਹੀਂ ਨਹੀਂ ਜ਼ਰੂਰ ਜੀ ਨਹੀਂ ਨਹੀਂ ਕੋਈ ਨਹੀਂ ਜੋ ਵੀ ਆਪਾਂ ਨੁਕਸਾਨ ਆਪਾਂ ਕਰਾਂਗੇ ਹਾਂਜੀ ਠੀਕ ਹੈ ਓਕੇ